ਹੈਲੋ ਹਾਂਜੀ ਮੈਡਮ ਸਤਿ ਸ਼੍ਰੀ ਅਕਾਲ ਜੀ ਹੋਰ ਮੈਡਮ ਠੀਕ ਠਾਕ ਓਂ ਜੀ ਬਸ ਵਧੀਆ ਜੀ ਵਧੀਆ ਸਭ ਕੁਛ ਬਹੁਤ ਵਧੀਆ ਜੀ ਸਭ ਵਧੀਆ ਹਾਂਜੀ ਮੈਡਮ ਹਾਂਜੀ ਅਸਲ ਦੇ ਵਿੱਚ ਮੈਡਮ ਜੇ ਗੱਲ ਕਰੀਏ ਆਪਾਂ ਦਾਖ਼ਲਿਆਂ ਦੀ ਤਾਂ ਦਾਖ਼ਲਿਆਂ ਦੇ ਵਿੱਚ ਨਾ ਜ਼ਿਆਦਾਤਰ ਇੰਜੀਨੀਅਰਿੰਗ ਲਾਈਨ ਦੇ ਵਿੱਚ ਬੱਚਿਆਂ ਦਾ ਨਾ ਕੰਪਿਊਟਰ ਵੱਲ ਬਹੁਤ ਜ਼ਿਆਦਾ ਰੁਝਾਨ ਵੱਧ ਰਿਹਾ ਅਤੇ ਕੰਪਿਊਟਰ ਸਾਇੰਸ ਦੇ ਵਿੱਚ ਦਾਖਲੇ ਬਹੁਤ ਜ਼ਿਆਦਾ ਨੇ ਅਤੇ ਇਸੇ ਕਰਕੇ ਜਿੱਦਾਂ ਮੈਂ ਆਪਣੇ ਡਿਪਾਰਟਮੈਂਟ ਦੀ ਗੱਲ ਕਰਾਂ ਮੇਰਾ ਇਲੈਕਟ੍ਰੋਨਿਕਸ ਡਿਪਾਰਟਮੈਂਟ ਆ ਅਤੇ ਫਿਰ ਅਸੀਂ ਵੀ ਇਸ ਵਾਰ ਇੱਥੇ ਕੀ ਕੀਤਾ ਅਸੀਂ ਨਾ ਇੱਕ ਨਵੀਂ ਇੰਟੀਗ੍ਰੇਟਿਡ ਬੀਟੈਕ ਕੋਰਸ ਸ਼ੁਰੂ ਕਰ ਲਿਆ ਬੀਟੈਕ ਇਲੈਕਟ੍ਰੋਨਿਕਸ ਐਂਡ ਕੰਪਿਊਟਰ ਇੰਜੀਨੀਅਰਿੰਗ ਇਹਦੇ ਵਿੱਚ ਅਸੀਂ ਫਿਫਟੀ ਫਿਫਟੀ ਪਰਸੈਂਟ ਰੱਖ ਲਿਆ ਵੀ ਅੱਧਾ ਕੰਪਿਊਟਰ ਹੋ ਗਿਆ ਅਤੇ ਅੱਧਾ ਇਲੈਕਟ੍ਰੋਨਿਕਸ ਰੱਖ ਲਿਆ ਇਹਦੇ ਵਿੱਚ ਇਸ ਵਾਰ ਬੱਚਿਆਂ ਦਾ ਮਤਲਬ ਬੜਾ ਚੰਗਾ ਰੁਝਾਨ ਦੇਖਣ ਨੂੰ ਮਿਲ ਰਿਹਾ ਅਤੇ ਮੈਂ ਮਤਲਬ ਇਹੀ ਕਹੂੰਗਾ ਕਿ ਕੰਪਿਊਟਰ ਵਾਲਾ ਜਿਹੜਾ ਹੈਗਾ ਨਾ ਫੀਲਡ ਇਸ ਨੂੰ ਹੋਰ ਕਿਸੇ ਫੀਲਡ ਨਾਲ਼ ਰਲਾ ਕੇ ਦਾਖ਼ਲੇ ਵੱਧ ਸਕਦੇ

ਨਹੀਂ ਨਹੀਂ ਮੈਡਮ ਤੁਹਾਡਾ ਸਵਾਗਤ ਹੈ ਜੀ ਮੋਸਟ ਵੈਲਕਮ ਕੋਈ ਨਹੀਂ ਆਪਾਂ ਮਿਲ ਕੇ ਗੱਲ ਕਰਾਂਗੇ ਜੀ ਠੀਕ ਹੈ ਜੀ ਚੰਗਾ ਜੀ ਸਤਿ ਸ਼੍ਰੀ ਅਕਾਲ ਸਾਸੀ ਸਤਿ ਸ਼੍ਰੀ ਅਕਾਲ